ਮੇਰਾ ਨਾਮ ਰਵਿੰਦਰ ਸਿੰਘ ਹੈ ਮੇਰਾ ਜਨਮ ਦਿਨ ਉੱਨੀ ਮਾਰਚ ਉੱਨੀ ਸੌ ਸਤਾਨਵੇਂ ਨੂੰ ਹੋਇਆ ਸੀਗਾ ਤਿੰਨ ਸਾਲ ਬਾਅਦ ਮੇਰੇ ਜਨਮ ਹੋਣ ਦੇ ਤਿੰਨ ਸਾਲ ਬਾਅਦ ਮੇਰਾ ਦਾਖਲਾ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਮੈਨੂੰ ਮੁਹਾਰਨੀ ਤੋਂ ਲੈ ਕੇ ਊੜੇ ਆੜੇ ਤੱਕ ਮੈਨੂੰ ਸਿਖਾਇਆ ਪੰਜਾਬੀ ਦੇ ਵਿੱਚ ਸਿਖਾਇਆ ਗਿਆ ਸੀ ਅਤੇ ਊੜਾ ਆੜਾ ਈੜੀ ਸਸਾ ਹਾਹ ਇਹ ਤਾਂ ਨ ਲਲੇ ਪੈਰ ਬਿੰਦੀ ਤੱਕ ਮੈਨੂੰ ਸਿਖਾਇਆ ਗਿਆ ਅਤੇ ਉਸ ਦੇ ਮਤਲਬ ਦੱਸੇ ਗਏ ਅਤੇ ਪੰਜਾਬੀ ਪੜ੍ਹਨੀ ਲਿਖਣੀ ਸਿਖਾਈ ਗਈ ਉੱਥੇ ਮੈਨੂੰ ਸਭ ਕੁਛ ਪੰਜਾਬੀ ਦੇ ਵਿੱਚ ਲਿਖਣਾ ਕਿੱਦਾਂ ਬੋਲਣਾ ਸ਼ਬਦ ਜੋੜ ਅਤੇ ਮੁਹਾਰਨੀ ਬਾਰੇ ਗਿਆਨ ਪ੍ਰਾਪਤ ਹੋਇਆ ਜੋ ਕਿ ਮੈਂ ਅੱਗੇ ਤੋਂ ਅੱਗੇ ਕਲਾਸ ਦੇ ਵਿੱਚ ਦਾਖਲਾ ਲੈਂਦਾ ਰਿਹਾ ਅਤੇ ਮੇਰਾ ਪੰਜਾਬੀ ਲਿਖਣ ਬੋਲਣ ਅਤੇ ਪੜ੍ਹਨ ਦੇ ਵਿੱਚ ਗਿਆਨ ਵੱਧਦਾ ਗਿਆ ਸਾਲ ਬਰ ਸਾਲ ਮੈਂ ਅੱਗੇ ਵੱਧਦਾ ਗਿਆ ਕਲਾਸ ਪਹਿਲੀ ਤੋਂ ਦੂਜੀ ਦੂਜੀ ਤੋਂ ਤੀਜੀ ਤੀਜੀ ਤੋਂ ਚੌਥੀ ਚੌਥੀ ਤੋਂ ਪੰਜਵੀਂ ਕਲਾਸ ਦੇ ਵਿੱਚ ਹੁੰਦਾ ਗਿਆ ਅਤੇ ਇੱਦਾਂ ਹੀ ਮੇਰਾ ਤਜਰਬਾ ਪੰਜਾਬੀ ਲਿਖਣ ਪੜ੍ਹਨ ਦੇ ਵਿੱਚ ਵੱਧਦਾ ਗਿਆ ਮੈਨੂੰ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਲਿਖਣੀ ਪੜ੍ਹਨੀ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਆਉਂਦੀ ਮੇਰੀ ਅੱਜ ਕੁਆਲੀਫਿਕੇਸ਼ਨ ਦਸਵੀਂ ਮੈਂ ਪਿੰਡ ਦੀ ਸਕੂਲ ਸਰਕਾਰੀ ਹਾਈ ਸਕੂਲ ਹੰਡਿਆਇਆ ਤੋਂ ਕੀਤੀ ਅਤੇ ਮੈਂ ਬ ਦਾ ਬਾਰ੍ਹਵੀਂ ਮੈਂ ਖੁੱਡੀ ਕਲਾਂ ਸਕੂਲ ਸੀਨੀਅਰ ਸੈਕੰਡਰੀ ਸਕੂਲ ਖੁੱਡੀ ਕਲਾਂ ਤੋਂ ਕੀਤੀ ਬੀ ਏ ਮੈਨੇ ਸੇ ਯੂਨੀਵਰਸਿਟੀ ਕਾਲਜ ਬਰਨਾਲਾ ਤੋਂ ਕੀਤੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਮੈਂ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ ਮਾਸਟਰ ਡਿਗਰੀ ਕੀਤੀ ਮੈਨੇ ਪਟਿਆਲਾ ਯੂਨੀਵਰਸਿਟੀ ਤੋਂ ਕੀਤੀ ਹੈ ਤਾਂ ਕਿ ਮੈਨੂੰ ਅੱਜ ਪੰਜਾਬੀ ਐਮ ਏ ਦਾ ਮੈਂ ਇੱਕ ਵਿਦਿਆਰਥੀ ਹਾਂ ਮੈਨੂੰ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਪੰਜਾਬੀ ਬੋਲਣ ਅਤੇ ਲਿਖਣ ਦੇ ਵਿੱਚ